ਸਕੂਲ ਦੇ ਵਿੱਚ ਸਕੂਲ ਦੇ ਸਮੇਂ ਦੇ ਵਿੱਚ ਮੇਰੀ ਪੇਂਟਿੰਗ ਕੁਛ ਜ਼ਿਆਦਾ ਵਧੀਆ ਨਹੀਂ ਸੀਗੀ ਅਤੇ ਮੈਨੂੰ ਪੇਂਟਿੰਗ ਦੇ ਵਿੱਚ ਮੋਸਟਲੀ ਘਰ ਬਣਾਉਣਾ ਬਹੁਤ ਇਜ਼ੀ ਲੱਗਦਾ ਸੀਗਾ ਅਤੇ ਮੈਂ ਜਦ ਵੀ ਸਾਡੀ ਪੀਰੀਅਡ ਪੇਂਟਿੰਗ ਦਾ ਹੁੰਦਾ ਸੀਗਾ ਅਤੇ ਮੈਨੂੰ ਹੁੰਦਾ ਸੀਗਾ ਕਿ ਫਟਾਫਟ ਇੱਕ ਛੋਟੀ ਜਿਹੀ ਹੱਟ ਬਣਾ ਕੇ ਸਰ ਨੂੰ ਪੇਸ਼ ਕਰ ਦਿੱਤਾ ਜਾਵੇ ਅਤੇ ਕਿਉਂਕਿ ਸਭ ਤੋਂ ਇਜ਼ੀਲੀ ਮੈਨੂੰ ਉਹੀ ਲੱਗਦਾ ਸੀਗਾ ਸਭ ਤੋਂ ਜ਼ਿਆਦਾ ਮੈਨੂੰ ਔਖਾ ਲੱਗਦਾ ਸੀਗਾ ਕਿਸੀ ਕਿਸੇ ਚੀਜ਼ ਨੂੰ ਸ਼ੇਪ ਦੇ ਵਿੱਚ ਬਣਾਉਣਾ ਅਤੇ ਸਾਡੇ ਸਰ ਨੂੰ ਵੀ ਥੋੜ੍ਹਾ ਜਿਹਾ ਔਖਾ ਲੱਗਦਾ ਸੀ ਸਮਝਾਉਣਾ ਅਤੇ ਕਿਉਂਕਿ ਅਸੀਂ ਪੇਂਟਿੰਗ ਦੇ ਵਿੱਚ ਸਾਡਾ ਹੱਥ ਥੋੜ੍ਹਾ ਟਾਈਟ ਸੀਗਾ ਬਟ ਅਸੀਂ ਕੋਸ਼ਿਸ਼ ਕਰੀਦੀ ਕਿ ਚਲੋ ਜਿਤਨਾ ਵੀ ਹੋ ਸਕਿਆ ਆਪਣੇ ਵੱਲੋਂ ਵਧੀਆ ਬਣਾਈਏ ਅਤੇ ਅਸੀਂ ਮੈਂ ਸਕੂਲ ਦੀ ਪੇਂਟਿੰਗ ਦਾ ਆਈਡੀਆ ਮੇਰਾ ਠੀਕ ਠੀਕ ਹੀ ਰਿਹਾ ਮੇਰਾ ਐਕਸਪੀਰੀਅੰਸ ਮੇਰਾ ਚਲੋ ਬਹੁਤ ਅੱਛਾ ਨਹੀਂ ਸੀਗਾ ਬਟ ਸਾਡੇ ਸਰ ਬਹੁਤ ਅੱਛੇ ਸੀਗੇ ਉਹ ਸਾਡੀ ਹੈਲਪ ਬਹੁਤ ਕਰਦੇ ਸੀਗੇ ਬਟ ਪੇਂਟਿੰਗ ਪਰ ਕਾਰਡਸ ਵਗੈਰਾ ਜਦੋਂ ਛੋਟੇ ਹੁੰਦੇ ਆਪਾਂ ਬਹੁਤ ਗਿਫਟ ਕੀਤੇ ਹੈ ਅਤੇ ਉਸ ਟਾਈਮ ਉਹ ਸਮਾਂ ਬਹੁਤ ਵਧੀਆ ਸੀਗਾ ਸਾਡੇ ਵਾਸਤੇ ਅਤੇ ਅਜੇ ਵੀ ਜਦ ਛੋਟੇ ਬੱਚੇ ਸਾਨੂੰ ਕਦੀ ਕੋਈ ਕਾਰਡ ਦਿੰਦੇ ਆ ਜਾਂ ਕੋਈ ਗਿਫਟ ਜਾਂ ਛੋਟਾ ਪੈਕ ਕਰਕੇ ਦਿੰਦੇ ਤਾਂ ਸਾਨੂੰ ਆਪਣੇ ਟਾਈਮ ਦਾ ਸਮਾਂ ਯਾਦ ਆਉਂਦਾ ਕਿ ਜਦ ਅਸੀਂ ਪੇਂਟਿੰਗ ਕਰਦੇ ਹੁੰਦੇ ਸੀਗੇ ਤਾਂ ਪੇਂਟਿੰਗ ਦਾ ਭਾਵ ਵੱਖਰੀ ਵੱਖਰੀ ਚੀਜ਼ਾਂ ਬਣਾ ਕੇ ਆਪਣੇ ਸਰ ਨੂੰ ਦੇ ਦਿੰਦੇ ਸੀਗੇ ਕਿ ਸਰ ਆਹ ਸਾਡਾ ਕਾਰਡ ਤੁਹਾਡੇ ਲਈ ਸਰ ਤੁਹਾਡਾ ਬਰਥਡੇ ਸਰ ਤੁਹਾਡਾ ਜੇ ਅਤੇ ਸਪੈਸ਼ਲੀ ਟੀਚਰਸ ਦੇ ਤਾਂ ਆਪਾਂ ਬਹੁਤ ਕਾਰਡ ਦਿੱਤੇ ਬੱਚਿਆਂ ਨੂੰ ਅਤੇ ਉਹ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਸਾਡਾ ਉਸ ਟਾਈਮ ਦਾ ਅਤੇ ਅਜੇ ਵੀ ਅਸੀਂ ਸਮਟਾਈਮ ਬੱਚੇ ਕਾਰਡ ਲਿਆਉਂਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਉਹਦੀ